ਤਕਨੋਲੋਜੀ ਸਾਡੇ ਕੰਮ ਕਰਨ ਦੇ ਸਾਧਨ ਸੰਚਾਰ ਨੂੰ ਬਹੁਤ ਤਰੀਕਿਆਂ ਰਾਹੀਂ ਬਦਲ ਰਹੀ ਹੈ ਜਿਵੇਂ ਕਿ ਅਸੀਂ ਦੇਖਿਆ ਜਾਵੇ ਸ਼ੋਸ਼ਲ ਮੀਡੀਆ ਨੈਟਵਰਕ ਸ਼ੋਸ਼ਲ ਮੀਡੀਆ ਨੈਟਵਰਕ 'ਤੇ ਸਾਨੂੰ ਬਹੁਤ ਸਾਰੀਆਂ ਖ਼ਬਰਾਂ ਦਾ ਪਤਾ ਲੱਗਦਾ ਸਾਨੂੰ ਦੁਰਾਡੇ ਦੀਆਂ ਖ਼ਬਰਾਂ ਦਾ ਪਤਾ ਲੱਗਦਾ ਬਾਹਰ ਦੁਨੀਆ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸਾਰੀਆਂ ਖ਼ਬਰਾਂ ਕਿੱਥੇ ਐਕਸੀਡੈਂਟ ਦੀਆਂ ਖ਼ਬਰਾਂ ਜਾਂ ਕੋਈ ਰੂਲ ਚੇਂਜ ਹੋਣ ਦੀਆਂ ਖ਼ਬਰਾਂ ਸਾਰਾ ਪਤਾ ਲੱਗਦਾ ਜੇ ਚੈਟ ਐਪਲੀਕੇਸ਼ਨਸ ਦੀ ਗੱਲ ਕਰੀਏ ਤਾਂ ਚੈਟ ਐਪਲੀਕੇਸ਼ਨਸ ਦੇ ਵਿੱਚ ਜਿੱਦਾਂ ਅਸੀਂ ਵ੍ਹਾਟਸਅਪ 'ਤੇ ਵੀ ਚੈਟ ਕਰ ਸਕਦੇ ਹਾਂ ਸਨੈਪਚੈਟ 'ਤੇ ਵੀ ਚੈਟ ਕਰ ਸਕਦੇ ਹਾਂ ਟੈਲੀਗਰਾਮ 'ਤੇ ਵੀ ਚੈਟ ਕਰ ਸਕਦੇ ਹਾਂ ਇੰਸਰਾਗ੍ਰਾਮ 'ਤੇ ਵੀ ਚੈਟ ਕਰ ਸਕਦੇ ਹਾਂ ਵੀ ਇਹ ਮੁੱਖ ਚੈਟ ਦੇ ਸਾਧਨ ਨੇ ਜਦੋਂ ਕਿ ਅਸੀਂ ਆਪਣੇ ਅਸੀਂ ਇੱਕ ਦੂਜੇ ਨਾਲ ਚੈਟ ਕਰ ਸਕਦੇ ਹਾਂ ਗੱਲਬਾਤ ਕਰ ਸਕਦੇ ਹਾਂ ਇਹਨਾਂ ਸਾਧਨਾਂ ਰਾਹੀਂ ਅਸੀਂ ਇੱਕ ਦੂਜੇ ਨਾਲ ਚੈਟ ਕਰ ਸਕਦੇ ਹਾਂ ਜੇ ਅਸੀਂ ਪੇਡ ਵਾਲੇ ਸੰਚਾਰ ਦੇ ਸਾਧਨਾਂ ਦੀ ਗੱਲ ਕਰੀਏ ਤਾਂ ਪੇਡ ਵਾਲੇ ਸੰਚਾਰ ਦੇ ਸਾਧਨ ਜਿੱਦਾਂ ਕਿ ਗੂਗਲ ਪੇ ਪੇਟੀਐਮ ਫੋਨਪੇ ਇਹਨਾਂ ਰਾਹੀਂ ਅਸੀਂ ਇੱਕ ਦੂਜੇ ਨੂੰ ਪੈਸੇ ਟ੍ਰਾਂਸਫਰ ਕਰ ਸਕਦੇ ਹਾਂ ਜਿੱਦਾਂ ਕਿ ਅਸੀਂ ਇੱਕ ਤੋਂ ਦੂਜੇ ਸ਼ਹਿਰ ਦੇ ਵਿੱਚ ਵੀ ਕਿਸੇ ਨੂੰ ਪ ਪੈਸੇ ਟ੍ਰਾਂਸਫਰ ਕਰਨੇ ਹੋਣ ਤਾਂ ਇਸ ਤਰੀਕੇ ਰਾਹੀਂ ਅਸੀਂ ਅ ਪੈਸੇ ਟਰਾਂਸਫਰ ਕਰ ਸਕਦੇ ਹਾਂ ਕਿਉਂਕਿ ਸੰਚਾਰ ਦੇ ਬਹੁਤ ਅਜਿਹੇ ਸਾਧਨ ਨੇ ਜਿਹਨਾਂ ਕਰਕੇ ਸਾਨੂੰ ਬਹੁਤ ਜ਼ਿਆਦਾ ਸੌਖ ਮਿਲੀ ਆ ਅਤੇ ਅਸੀਂ ਬਹੁਤ ਸਾਰੇ ਕੰਮਾਂ ਨੂੰ ਆਸਾਨੀ ਦੇ ਤਰੀਕੇ ਨਾਲ ਕਰ ਸਕਦੇ ਹਾਂ ਸਾਡਾ ਕੁਝ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਇਹਨਾਂ ਨੂੰ ਕੰਮਾਂ ਨੂੰ ਕਰਨ ਲਈ